ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੈਂ ਬੀ ਏ ਦੀ ਸਟੱਡੀ ਕੀਤੀ ਹੈ ਅਤੇ ਅੱਗੇ ਜਾ ਕੇ ਵੀ ਮੈਂ ਕੀ ਕਰ ਸਕਦੀ ਹਾਂ ਅਤੇ ਉਸ ਤਰ੍ਹਾਂ ਦਾ ਮੈਨੂੰ ਕੋਈ ਉਹ ਦੱਸਿਆ ਜਾਵੇ ਕੋਈ ਵੀ ਨੌਕਰੀ ਵਾਸਤੇ ਅੱਗੇ ਜਾ ਕੇ ਮੈਨੂੰ ਫਾਇਦਾ ਹੋਵੇ ਠੀਕ ਹੈ ਸਰ

ਠੀਕ ਹੈ ਸਰ ਠੀਕ ਹੈ ਸਰ ਅਤੇ ਉਹ ਤੋਂ ਬਾਅਦ ਸਰ ਪੇਪਰ ਦੀ ਤਿਆਰੀ ਅਲੱਗ ਤੋਂ ਕਰਨੀ ਪਏਗੀ ਠੀਕ ਹੈ ਸਰ ਥੈਂਕ ਯੂ ਸਰ